ਊਂ ਤਾਂ ਵੈਸੇ ਤਾਂ ਬਹੁਤ ਸਾਰੀਆਂ ਬਾਈਕਸ ਹੈਗੀਆਂ ਨੇਗੀਆਂ ਜਿਹੜੀਆਂ ਬਹੁਤ ਸਾਰੀਆਂ ਹੈਗੀਆਂ ਬਾਈਕਸ ਪਰ ਮੈਨੂੰ ਜਿਹੜੀ ਹੈਗੀ ਹੈਗੀ ਬਾਈਕ ਦੇ ਵਿੱਚ ਬੁਲਟ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਬੁਲਟ ਮੇਰੇ ਜਿਹੜੀ ਹੈਗੀ ਆ ਫੇਵ ਬਹੁਤ ਮਨ ਪਸੰਦ ਸਾਧਨ ਹੈਗਾ ਹੈਗਾ ਅਤੇ ਇਹ ਬਸ ਮੈਨੂੰ ਇਹਦੇ 'ਤੇ ਮੈਨੂੰ ਵਾਹਿਗੁਰੂ ਇਹਨੂੰ ਡਰਾਈਵ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਅਤੇ ਮੈਨੂੰ ਇਹਦੇ 'ਚ ਡਰਾਈਵ ਕਰਨ ਦੇ ਮੈਨੂੰ ਮੇਰਾ ਡਰੀਮ ਸੀਗਾ ਕਿ ਮੈਂ ਬੁਲਟ ਡਰਾਈਵ ਕਰਾਂ ਅਤੇ ਉਹ ਮੈਂ ਹੁਣ ਆਪਣਾ ਡਰੀਮ ਪੂਰਾ ਕੀਤਾ ਮੈਨੂੰ ਬਹੁਤ ਵਧੀਆ ਲੱਗਦੀ ਆ ਬਟ ਜਿਹੜੀ ਆਪਾਂ ਜਾਂਦੇ ਹੈਗੇ ਜਦੋਂ ਆਪਾਂ ਯਾਤਰਾ ਕਰਦੇ ਹੈਗੇ ਐਗੇ ਕਿਤੇ ਜਾਂ ਦੂਰ ਜਾਂਦੇ ਹੈਗੇ ਆ ਉਹਦੇ ਲਈ ਆਪਾਂ ਨੂੰ ਜਿਹੜੀ ਬੁਲੇਟ ਹੈਗੀ ਹੈ ਉਹ ਸੇਫ ਨਹੀ ਹੈਗੀ ਇਸ ਲਈ ਆਪਾਂ ਨੂੰ ਇਹਦੇ 'ਤੇ ਬਾਈਕ ਖਰੀਦਣੀ ਜਾਂ ਲੈਣੀ ਚਾਹੀਦੀ ਹੈਗੀ ਐਗੀ ਅਤੇ ਜਿਵੇਂ ਆਪਾਂ ਕੀ ਕਹਿੰਦੇ ਹੁੰਦੇ ਆ ਵੀ ਬ ਸਪਲੈਂਡਰ ਪਲੱਸ ਹੋ ਗਿਆ ਜਾਂ ਕੁਛ ਵੀ ਵੱਡਾ ਮੋਟਰਸਾਈਕਲ ਹੋ ਗਿਆ ਉਹ ਆਪਾਂ ਨੂੰ ਵਰਤਣਾ ਚਾਹੀਦਾ ਕਿਉਂਕਿ ਉਹਦੇ ਪਿੱਛੇ ਇੱਕ ਤਾਂ ਆਪਾਂ ਜਿਹੜਾ ਅਜ ਕਿਤੇ ਜਾ ਰਹੇ ਹੈਗੇ ਹਾਂ ਆਪਾਂ ਆਪਦਾ ਉਹ ਬੰਨ੍ਹ ਲਾਂਗੇ ਬੈਗ ਵਗੈਰਾ ਰੱਖ ਸਕਦੇ ਹਾਂ ਪਿੱਛੇ ਅਤੇ ਜੇ ਉਹਦੇ ਨਾਲ ਆਪਾਂ ਜੇ ਕਿਸੇ ਨੂੰ ਬਿਠਾਉਂਦੇ ਹਾਂ ਉਹ ਵੀ ਕੰਫਰਟੇਬਲ ਆਪਦੇ ਪੈਰ ਚੰਗੀ ਤਰ੍ਹਾਂ ਕੰਫਰਟੇਬਲ ਰੱਖ ਸਕਦਾ ਉੱਥੇ ਅਤੇ ਉਹਨੂੰ ਜਿਹੜਾ ਆਪਾਂ ਹੈਗਾ ਕਿਤੇ ਵੀ ਰੋਕ ਕੇ ਉਤਾਰ ਸਕਦੇ ਹੈਗੇ ਐਗੇ ਅਤੇ ਉਤਾਰਨ ਨਾਲ ਆਪਾਂ ਉਹਨੂੰ ਪੈਰ ਵੀ ਨਹੀਂ ਚਲਾ ਸਕਦੇ ਹਾਂ ਅਤੇ ਬਾਈਕ ਨੂੰ ਆਪਾਂ ਜ਼ਿਆਦਾ ਫਾਸਟ ਨਹੀਂ ਘੱਟ ਸਪੀਡ ਦੇ ਉੱਪਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲਿਜਾਣਾ ਸੌਖਾ ਹੋ ਜਾਵੇਗਾ ਇਹ ਇਹਦੇ ਨਾਲ ਕੀ ਹੁੰਦਾ ਹੈਗਾ ਆਪਾਂ ਨਾਲੇ ਯਾਤਰਾ ਦਾ ਸਫਰ ਆਪਾਂ ਇੰਜੋਏ ਕਰਦੇ ਹਾਂ ਬਾਈਕ ਦੇ ਆਪਾਂ ਆਪਦੇ ਜਦੋਂ ਆਣ ਜਾਂਦੇ ਹਾਂ ਤਾਂ ਇੱਧਰ ਉੱਧਰ ਵਾਤਾਵਰਨ ਆਪਦਾ ਦੇਖਦੇ ਜਾਂਦੇ ਹੈਗੇ ਹਾਂ ਅਤੇ ਜਿਵੇਂ ਆਪਾਂ ਕਿਤੇ ਪਹਾੜਾ 'ਤੇ ਜਾਂਦੇ ਹਾਂ ਤਾਂ ਆਪਾਂ ਨੂੰ ਇਹ ਨੂੰ ਬਾਈਕ ਨੂੰ ਪ੍ਰੋਪਰ ਕਰਕੇ ਕੰਪਲੀਟ ਫਿਰ ਆਪਾਂ ਨੂੰ ਚਲਾਉਣਾ ਚਾਹੀਦਾ ਹੈ ਉਹਦੀ ਪ੍ਰੋਪਰ ਸਰਵਿਸ ਹੋਈ ਵੀ ਹੋਣੀ ਚਾਹੀਦੀ ਹੈਗੀ ਆ ਇਹੀ ਆਪਣੇ ਲਈ ਆਰਾਮਦਾਇਕ ਹੋਣੀ ਚਾਹੀਦੀ ਹੈਗੀ ਐਗੀ